ਹਾਂਜੀ ਦੇਖੋ ਜੀ ਇੰਝ ਗੱਲ ਬਾਤ ਹੈਗੀ ਹੈ ਵੀ ਬੁਣਾਈ ਅਤੇ ਸਿਖਲਾਈ ਅਤੇ ਤਕਨੀਕਾਂ ਤਾਂ ਹੁਣ ਯੁੱਗ ਹੀ ਤਕਨੀਕਾਂ ਦਾ ਹੈ ਸ਼ੈਲੀਆਂ ਦਾ ਹੈ ਨਵਾਂ ਨਵਾਂ ਕੁਛ ਸਿੱਖਣ ਦਾ ਹੈ ਅਤੇ ਇਹ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ ਨਾ ਅਤੇ ਅੱਜ ਕੱਲ੍ਹ ਫੈਸ਼ਨ ਦਾ ਯੁੱਗ ਹੈ ਨਵਾਂ ਨਵਾਂ ਇੱਕ ਫੈਸ਼ਨ ਇੱਕ ਵਾਰ ਆ ਗਿਆ ਦੂਸਰੀ ਵਾਰ ਦੂਸਰਾ ਫੈਸ਼ਨ ਆ ਗਿਆ ਤੀਸਰੀ ਵਾਰ ਤੀਸਰਾ ਇੱਕ ਵਾਰ ਇੱਕ ਵਾਰ ਚੱਲਦਾ ਦੂਸਰੀ ਵਾਰ ਦੂਸਰਾ ਤੀਸਰੀ ਵਰ ਫੈਸ਼ਨ ਦਾ ਹੀ ਯੁੱਗ ਹੈ ਅਤੇ ਇਸ ਕਰਕੇ ਅਸੀਂ ਸਾਨੂੰ ਰੋਜ਼ ਰੋਜ਼ ਅਸੀਂ ਸਾਨੂੰ ਸਿੱਖਣਾ ਪੈਂਦਾ ਹੈ ਅਤੇ ਰੋਜ਼ ਰੋਜ਼ ਸਾਨੂੰ ਨਵੇਂ ਡਿਜਾਈਨ ਦੀ ਖੋਜ ਕਰਨੀ ਪੈਂਦੀ ਹੈ ਕਿਉਂਕਿ ਇੱਕ ਵਾਰ ਇੱਕ ਡਿਜਾਈਨ ਕਿਸੇ ਨੇ ਪਾ ਲਿਆ ਦੂਸਰੀ ਵਾਰ ਦੂਸਰਾ ਡਿਜਾਈਨ ਉਹਦੇ ਨਾਲ ਦਾ ਸੇਮ ਕਿਸੇ ਨੇ ਪਾਉਣਾ ਨਹੀਂ ਇਸ ਕਰਕੇ ਇਹ ਤਕਨੀਕਾਂ ਦਾ ਯੁੱਗ ਹੈ ਸ਼ੈਲੀਆਂ ਦਾ ਯੁੱਗ ਹੀ ਸ਼ੈਲੀਆਂ ਦਾ ਸਾਨੂੰ ਰੋਜ਼ ਰੋਜ਼ ਨਵੇਂ ਡਿਜਾਈਨ ਨਵੇਂ ਤਕਨੀਕਾਂ ਸਿੱਖਣੀਆਂ ਪੈਂਦੀਆਂ ਜਿਵੇਂ ਹੁਣ ਸਿਲਾਈ ਦੇ ਵਿੱਚ ਨਿੱਤ ਨਵਾਂ ਡਿਜਾਈਨ ਆਉਂਦਾ ਅਤੇ ਇ ਇੱਕ ਸਲਵਾਰ ਅਸੀਂ ਬਣਾਉਣੀ ਹੈ ਤਾਂ ਉਹ ਉਹ ਅਸੀਂ ਚਾਰ ਪੰਜ ਤਕਨੀਕਾਂ ਦੇ ਨਾਲ ਬਣਾ ਸਕਦੇ ਹਾਂ ਇਹ ਸਾਨੂੰ ਤਕਨੀਕ ਸਿੱਖਣ ਦੀ ਲੋੜ ਹੈ ਸਾਨੂੰ ਰੋਜ਼ ਹੀ ਸਿੱਖਣਾ ਪੈਂਦਾ ਅਤੇ ਅਲੱਗ ਅਲੱਗ ਤਰ੍ਹਾਂ ਦੇ ਡਿਜਾਈਨ ਅਤੇ ਫਿਰ ਜੇ ਬੁਣਾਈ ਦੇ ਵਿੱਚ ਆ ਗਈਆਂ ਤਾਂ ਹੁਣ ਨ ਬੁਣਾਈ ਦੇ ਵਿੱਚ ਅੱਜ ਕੱਲ੍ਹ ਨਵੇਂ ਸਟਾਇਲ ਦੀਆਂ ਜੁਰਾਬਾਂ ਚੱਲਦੀਆਂ ਅੱਗੇ ਤਾਂ ਇੱਕੋਂ ਤਰ੍ਹਾਂ ਦੀਆਂ ਜੁਰਾਬਾਂ ਚੱਲਦੀਆਂ ਹੁੰਦੀਆਂ ਸੀ ਹੁਣ ਨਵੇਂ ਡਿਜਾਈਨ ਦੀਆਂ ਜੁਰਾਬਾਂ ਚੱਲਦੀਆਂ ਅਤੇ ਛੋਟੀਆਂ ਛੋਟੀਆਂ ਜੁਰਾਬਾਂ ਚੱਲਦੀਆਂ ਅਤੇ ਅੱਗੇ ਸਿੰਪਲ ਵੱਡੀਆਂ ਵੱਡੀਆਂ ਜੁਰਾਬਾਂ ਚੱਲਦੀਆਂ ਹੁੰਦੀਆਂ ਸੀਗੀਆਂ ਫਿਰ ਨਾਲਿਆਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਡਿਜਾਈਨ ਆ ਗਏ ਫੈਸ਼ਨ ਦਾ ਯੁੱਗ ਹੈ ਅਤੇ ਇਹ ਅਸੀਂ ਔਨਲਾਈਨ ਵਧੀਆ ਸਾਨੂੰ ਇਹ ਟਕਨੀਕ ਮਿਲੀ ਹੈ ਵੀ ਔਨਲਾਈਨ ਅਸੀਂ ਕੁਛ ਮਰਜੀ ਡਿਜਾਈਨ ਵੇਖ ਕੇ ਅਸੀਂ ਬਣਾ ਸਕਦੇ ਆਂ ਕਰ ਸਕਦੇ ਹਾਂ ਅਤੇ ਅਸੀਂ ਆਪਣਾ ਕਾਰੋਬਾਰ ਖੋਲ੍ਹ ਕੇ ਅਤੇ ਅਸੀਂ ਆਪਣਾ ਸੌਖਾ ਹੋ ਸਕਦੇ ਹਾਂ ਅਤੇ ਪਰ ਸਿੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕਿਉਂਕਿ ਸਿੱਖਣਾ ਸਾਰੀ ਉਮਰ ਬੰਦਾ ਸਿੱਖਦਾ ਸਿੱਖਦਾ ਹੀ ਮੁੱਕ ਜਾਂਦਾ ਪਰ ਸਿੱਖਣਾ ਖਤਮ ਨਹੀਂ ਹੁੰਦਾ ਕਿਉਂਕਿ ਇਹ ਨਵਾਂ ਨਵਾਂ ਯੁੱਗ ਹੈ ਨਵੀਂ ਨਵੀਂ ਤਕਨੀਕ ਰੋਜ਼ ਨਵੀਂ ਟਕਨੀਕ ਆਉਂਦੀ ਹੈ ਅਤੇ ਸਾਨੂੰ ਰੋਜ਼ ਸਿੱਖਣਾ ਪੈਂਦਾ ਹੈ ਅਤੇ ਅਸੀਂ ਇਹ ਇਸ ਚੀਜ਼ ਨੂੰ ਫੋਨ ਤੋਂ ਖੋਜ ਕੇ ਕਰਕੇ ਸਿੱਖਦੇ ਹਾਂ ਜਾਂ ਸਾਨੂੰ ਹੁਣ ਆਪਣੇ ਆਪ ਹੀ ਆਟੋਮੈਟਿਕ ਟਕਨੀਕ ਆਈ ਜਾਂਦੀ ਹੈ ਦਿਮਾਗ ਦੇ ਵਿੱਚ ਜਦੋਂ ਕਰਨ ਲੱਗ ਜਾਈਏ ਤਾਂ ਆਪੋ ਆਪਣੇ ਡਿਜਾਈਨ ਆਈ ਜਾਂਦਾ ਅਤੇ ਆਪਣੇ ਆਪ ਸਾਨੂੰ ਜ਼ਿੰਦਗੀ ਰਸਤਾ ਦਿੰਦੀ ਹੈ ਕਿਉਂਕਿ ਇੱਕ ਵਾਰ ਅਸੀਂ ਰਸਤੇ 'ਤੇ ਚੱਲ ਪਈਏ ਨਾ ਤਾਂ ਸਾਨੂੰ ਡਿਜਾਈਨ ਤਕਨੀਕ ਦਿਮਾਗ 'ਚ ਆਟੋਮੈਟਿਕ ਹੀ ਆਈ ਜਾਂਦੀ ਕਿਉਂਕਿ ਆਪਾਂ ਇਹ ਬਚਪਨ ਤੋਂ ਹੀ ਇਸ ਕੰਮ ਕਰਦੇ ਹਾਂ ਅਤੇ ਆਪਾਂ ਨੂੰ ਆਪਾਂ ਸਿਲਾਈ ਕਟਾਈ ਦਾ ਕੋਰਸ ਕੀਤਾ ਅਤੇ ਉੱਥੋਂ ਆਪਾਂ ਬਹੁਤ ਕੁਝ ਸਿੱਖਿਆ ਅਤੇ ਅੱਗੇ ਵੀ ਹੁਣ ਆਪਾਂ ਉਹ ਉਮਰ ਹੋ ਗਈ ਆਪਾਂ ਕਰੀ ਜਾਂਦੇ ਹਾਂ ਸਿੱਖੀ ਜਾਂਦੇ ਹਾਂ ਅਤੇ ਅੱਗੇ ਵੀ ਚਾਅ ਵੀ ਹੈਗਾ ਹੋਰ ਵੀ ਸਿੱਖਣ ਦਾ ਬਹੁਤ ਚਾਅ ਹੈ ਧੰਨਵਾਦ